ਯੋਗਾ ਦਾ ਪਹਿਲੇ ਤਾਂ ਸਿਰਫ ਨਾਂ ਹੀ ਸੁਣਿਆ ਹੋਇਆ ਸੀ ਕਦੇ ਕਰਕੇ ਨਹੀਂ ਸੀ ਵੇਖਿਆ ਫਿਰ ਇੱਕ ਦਿਨ ਇੱਕ ਛੋਟੀ ਜਿਹੀ ਯੋਗਾ ਕਲਾਸ ਦੇ ਵਿੱਚ ਮੈਂ ਕਿਸੇ ਦੇ ਨਾਲ ਚਲਾ ਗਿਆ ਉੱਥੇ ਜਾ ਕੇ ਮੈਂ ਵੀ ਨਾਲ ਨਾਲ ਯੋਗਾ ਕੀਤਾ ਮੇਰਾ ਅਨੁਭਵ ਬਹੁਤ ਅੱਛਾ ਰਿਹਾ ਕਲਾਸ ਤੋਂ ਪਹਿਲਾਂ ਤਾਂ ਮੈਨੂੰ ਇੰਝ ਮਹਿਸੂਸ ਹੋਇਆ ਕਿ ਪਤਾ ਨਹੀਂ ਇਹ ਆਸਨ ਔਖੇ ਨੇ ਇਹ ਮੇਰੇ ਕੋਲੋਂ ਕੀਤੇ ਨਹੀਂ ਜਾਣੇ ਪਰ ਉਹ ਬੜੇ ਆਸਾਨ ਸੀ ਆਸਨ ਅਤੇ ਬਾਅਦ ਵਿੱਚ ਮੈਨੂੰ ਉਹ ਸਾਰੇ ਆਸਨ ਚੰਗੇ ਲੱਗਣ ਲੱਗ ਗਏ ਅਤੇ ਉਹਨਾਂ ਦਾ ਮੈਨੂ ਫਾਇਦਾ ਬਹੁਤ ਹੋਇਆ ਸਰੀਰ ਦੇ ਵਿੱਚ ਖੂਨ ਦਾ ਸੰਚਾਰ ਵੱਧ ਗਿਆ ਜਿਹੜੇ ਸਵੇਰੇ ਸ਼ਾਮ ਸਰੀਰ ਵਿੱਚ ਦਰਦਾਂ ਵਗੈਰਾ ਰਹਿੰਦੀਆਂ ਸੀ ਉਹ ਸਭ ਹੌਲੀ ਹੌਲੀ ਠੀਕ ਹੋਣ ਲੱਗ ਗਈਆਂ ਅਤੇ ਹੁਣ ਮੇਰਾ ਮਨ ਜਿਹੜਾ ਹੈ ਬਹੁਤ ਹੀ ਕਰਦਾ ਹੈ ਕਿ ਮੈਂ ਰੋਜ਼ ਹੀ ਯੋਗਾ ਕਰਾਂ ਹੁਣ ਮੈਂ ਤਕਰੀਬਨ ਇੱਕ ਦੋ ਆਸਨ ਸਵੇਰੇ ਸ਼ਾਮ ਆਪਣੇ ਆਪ ਘਰ ਹੀ ਕਰ ਲੈਂਦਾ ਹਾਂ ਅਤੇ ਜਿਸ ਦਿਨ ਨਾ ਕਰੋ ਤਾਂ ਬੜਾ ਹੀ ਅਜੀਬ ਜਿਹਾ ਮਹਿਸੂਸ ਹੁੰਦਾ ਹੈ ਕਿ ਅੱਜ ਯੋਗਾ ਨਹੀਂ ਕੀਤਾ ਅਤੇ ਜ਼ਰੂਰ ਕਰਨਾ ਸੀ